ਨੌਜਵਾਨ ਪੀੜ੍ਹੀ ਸੱਭਿਆਚਾਰ ਦੀ ਰੀਤਾਂ ਦੀ ਪਾਲਣਾ ਤਾਂ ਕਰਦੀ ਹੈ ਪਰ ਹੁਣ ਇਹ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਉਤਸ਼ਾਹ ਬਹੁਤ ਵੱਧ ਰਿਹਾ ਹੈ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਸਾਡਾਸੱਭਿਆਚਾਰ ਅਲੋਪ ਹੋ ਜਾਵੇਗਾ ਸਾਨੂੰ ਸਾਡੇ ਸੱਭਿਆਚਾਰ ਨੂੰ ਉੱਦਾਂ ਹੀ ਬਰਕਰਾਰ ਰੱਖਣਾ ਚਾਹੀਦਾ ਹੈ ਜਿਸ ਨਾਲ ਕੀ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਡੇ ਸੱਭਿਆਚਾਰ ਬਾਰੇ ਆਸਾਨੀ ਨਾਲ ਪਤਾ ਚੱਲ ਸਕੇ ਸਾਨੂੰ ਸਾਡੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਇਸ ਤੋਂ ਪਹਿਲਾਂ ਕਿ ਉਹ ਅਲੋਪ ਹੋ ਜਾਵੇ ਜਾਂ ਉਹ ਸਿਰਫ਼ ਕਿਤਾਬਾਂ ਵਿੱਚ ਹੀ ਰਹਿ ਜਾਵੇ